ਮੇਰਾ ਨਾਂ ਸ਼ੀਤਲ ਕੁਮਾਰੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਗੱਲ ਕਰਾਂ ਕਰਾਂ ਮੇਰੇ ਸ਼ੌਕ ਦੀ ਮੈਨੂੰ ਕਾਫ਼ੀ ਸ਼ੌਕ ਹਨ ਉਨ੍ਹਾਂ ਵਿੱਚੋਂ ਮੇਰਾ ਇੱਕ ਸ਼ੌਕ ਬੂਟੇ ਅਤੇ ਪੇੜ ਪੌਦਿਆਂ ਨੂੰ ਉਗਾਉਣਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਮੈਂ ਬਚਪਨ ਤੋਂ ਹੀ ਪੇੜ ਪੌਦਿਆਂ ਨਾਲ ਕਾਫ਼ੀ ਜੁੜੀ ਹੋਈ ਹਾਂ ਮੈਂ ਨਿੱਕੇ ਹੁੰਦੇ ਤੋਂ ਹੀ ਆਪਣੇ ਘਰ ਵਿੱਚ ਪੇੜ ਪੌਦੇ ਉਗਾਉਂਦੀ ਸੀ ਜਿਸ ਨੂੰ ਮੈਂ ਰੋਜ਼ ਸਵੇਰੇ ਅਤੇ ਸ਼ਾਮ ਨੂੰ ਪਾਣੀ ਅਤੇ ਖਾਦ ਪਾਉਂਦੀ ਸੀ ਜਿਸ ਨਾਲ ਉਹ ਬਹੁਤ ਚੰਗੇ ਹੁੰਦੇ ਹਨ ਅਤੇ ਜੇ ਮੈਂ ਗੱਲ ਕਰਾਂ ਵੱਖ ਵੱਖ ਮੌਸਮਾਂ ਦੇ ਅਧਾਰ 'ਤੇ ਕਿਹੜੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਹਨ ਜੋ ਕਿ ਸਾਡੇ ਪੌਦਿਆਂ ਲਈ ਬਹੁਤ ਚੰਗੀ ਗੱਲ ਹੈ ਜਿਵੇਂ ਕਿ ਗੱਲ ਕਰਾਂ ਮੈਂ ਬਰਸਾਤ ਅਤੇ ਬਰਸਾਤਾਂ ਦੇ ਵਿੱਚ ਉਨ੍ਹਾਂ ਨੂੰ ਪਾਣੀ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਜਿਸ ਕਰਕੇ ਸਾਨੂੰ ਪਾਣੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਜੇ ਮਿੱਟੀ ਜ਼ਿਆਦਾ ਗਿੱਲੀ ਰਹੇਗੀ ਤਾਂ ਬ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਉਸਨੂੰ ਪਾਣੀ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇੱਕ ਗੱਲ ਪੌਦੇ ਨੂੰ ਹਰ ਤਰ੍ਹਾਂ ਦੀ ਚੀਜ਼ ਚਾਹੀਦੀ ਹੈ ਜਿਵੇਂ ਥੋੜ੍ਹੀ ਧੁੱਪ ਕੁਝ ਕੁ ਮਾਤਰਾ ਪਾਣੀ ਅਤੇ ਕੁਝ ਮਾਤਰਾ ਦੀ ਚੰਗੀ ਮਿੱਟੀ ਵੀ ਚਾਹੀਦੀ ਹੁੰਦੀ ਹੈ ਅਤੇ ਮੈਂ ਕੋਸ਼ਿਸ਼ ਹਰ ਵਾਰੀ ਇਹ ਕਰ ਰਹਿੰਦੀ ਹੈ ਕਿ ਮੈਂ ਉਪਜਾਊ ਮਿੱਟੀ ਦੇ ਵਿੱਚ ਹੀ ਪੌਦਾ ਉਗਾਵਾਂ ਜੋ ਮਿੱਟੀ ਜ਼ਿਆਦਾਤਰ ਮੈਂ ਨਰਸੀ ਵਿੱਚੋਂ ਲੈ ਕੇ ਆਉਂਦੀ ਹਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕੋਈ ਸਰਦੀਆਂ ਦੇ ਮੌਸਮ ਦੀ ਸਰਦੀਆਂ ਦੇ ਮੌਸਮ ਵਿੱਚ ਸਾਰੇ ਸਾਡੇ ਪੌਦਿਆਂ ਨੂੰ ਜ਼ਿਆਦਾਤਰ ਧੁੱਪ ਦੀ ਲੋੜ ਹੁੰਦੀ ਹੈ ਕਿਉਂਕਿ ਉਸ ਵਿੱਚ ਠੰਢ ਦੇ ਕਾਰਨ ਜਿਵੇਂ ਅਸੀਂ ਜਾਣਦੇ ਹਾਂ ਤਾਪਮਾਨ ਘੱਟ ਪੌਦਿਆਂ ਅਤੇ ਬਾਕੀ ਪੇੜ ਪੌਦਿਆਂ ਨੂੰ ਬਹੁਤ ਸਾਰੀ ਧੁੱਪ ਚਾਹੀਦੀ ਹੁੰਦੀ ਹੈ ਅਤੇ ਜੇ ਮੈਂ ਗੱਲ ਕਰਾਂ ਗਰਮੀਆਂ ਦੇ ਮੌਸਮ ਦੀ ਉਸ ਵਿੱਚ ਸਾਡੇ ਪੇੜ ਪੌਦਿਆਂ ਨੂੰ ਇੱਕ ਚੰਗੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ ਸਵੇਰੇ ਸ਼ਾਮ ਆਪਣੇ ਪੌਦਿਆਂ ਨੂੰ ਦਿੰਦੀ ਹਾਂ ਜਿਸ ਨਾਲ ਮੇਰੇ ਪੌਦੇ ਬਹੁਤ ਚੰਗੇ ਉੱਗਦੇ ਹਨ ਮੈਂ ਕਦੇ ਕਦੇ ਇਸ ਵਿੱਚ ਖਾਦ ਦਾ ਇਸਤੇਮਾਲ ਵੀ ਕਰਦੀ ਹਾਂ ਜਿਸ ਨਾਲ ਮੇਰੇ ਪੇੜ ਪੌਦੇ ਭਰੇ ਰਹਿੰਦੇ ਹਨ ਇਨ੍ਹਾਂ ਅਤੇ ਇਨ੍ਹਾਂ ਨੂੰ ਕੀੜੇ ਨਹੀਂ ਲੱਗਦੇ ਇਸ ਤਰ੍ਹਾਂ ਆਪਣੇ ਘਰ ਵਿੱਚ ਇੱਕ ਪੇੜ ਪੌਦੇ ਲਈ ਇੱਕ ਛੋਟੀ ਜਿਹੀ ਕਿਆਰੀ ਵੀ ਬਣਾਈ ਹੈ ਉਸ ਵਿੱਚ ਕਾਫੀ ਪੇੜ ਪੌਦੇ ਉਗਾਏ ਹਨ ਪੇੜ ਪੌਦੇ ਜ਼ਮੀਨ ਵਿੱਚ ਆਉਂਦੇ ਹਨ ਨਾਲ ਕਈ ਪੇੜ ਪੌਦੇ ਜ਼ਿਆਦਾ ਜਗ੍ਹਾ ਮਿਲਦੇ ਹਨ ਅਤੇ ਕਈ ਪੌਦੇ